ਮੈਂ ਕੁਝ ਮੁਸ਼ਕਿਲ ਪਕਵਾਨ ਬਾਰੇ ਦੱਸਣਾ ਚਾਹੁੰਦੀ ਹਾਂ ਜਿਹੜੇ ਮੈਨੂੰ ਬਣਾਉਣੇ ਨਹੀਂ ਆਉਂਦੇ ਇਹਦੇ ਵਿੱਚ ਸਾਗ ਸ਼ਲਗਮ ਦੀ ਸਬਜ਼ੀ ਮੱਕੀ ਦੀ ਰੋਟੀ ਅਤੇ ਤੰਦੂਰੀ ਰੋਟੀ ਇਹ ਪਕਵਾਨ ਮੈਨ ਮੈਂ ਸਿੱਖਣਾ ਸਿੱਖਣਾ ਚਾਹੁੰਦੀ ਹਾਂ ਸਾਗ ਬਣਾਉਣ ਦੀ ਗੱਲ ਕਰੀਏ ਤਾਂ ਸਾਗ ਬਣਾਉਣ ਲਈ ਟਾਈਮ ਬਹੁਤ ਲੱਗਦਾ ਹੈ ਇਹਨੂੰ ਲੱਕੜ ਦੇ ਨਾਲ ਘੋਟਣਾ ਪੈਂਦਾ ਹੈ ਜਿਸ ਕਾਰਨ ਬਾਹਵਾਂ ਦੀ ਬਹੁਤ ਕਸਰਤ ਹੁੰਦੀ ਅਤੇ ਬਾਹਵਾਂ ਦਰਦ ਕਰਨ ਲੱਗ ਜਾਂਦੀਆਂ ਹਨ ਇਹ ਇੱਕ ਮੁਸ਼ਕਿਲ ਪਕਵਾਨ ਸਿੱਖਣਾ ਚਾਹੁੰਦੀ ਹਾਂ ਸ਼ਲਗਮ ਦੀ ਗੱਲ ਕਰੀਏ ਤਾਂ ਇਹ ਸਾਗ ਦੀ ਤਰ੍ਹਾਂ ਹੀ ਬਣਾਉਣਾ ਪੈਂਦਾ ਹੈ ਸਾਗ ਦੀ ਤਰ੍ਹਾਂ ਹੀ ਬਣਾਉਣੀ ਪੈਂਦੀ ਹੈ ਮੱਕੀ ਸਾਰੀ ਮਿਹਨਤ ਸਾਗ ਵਾਂਗੂੰ ਹੀ ਕਰਨੀ ਪੈਂਦੀ ਹੈ ਮ ਫਿਰ ਇਸ ਤੋਂ ਬਾਅਦ ਮੱਕੀ ਦੀ ਰੋਟੀ ਦੀ ਗੱਲ ਕਰੀਏ ਤਾਂ ਮੱਕੀ ਦੀ ਰੋਟੀ 'ਤੇ ਵੀ ਮਿਹਨਤ ਲੱਗਦੀ ਹੈ ਉਹ ਜਦੋਂ ਹੱਥਾਂ 'ਤੇ ਪਕਾਈਏ ਤਾਂ ਹੱਥਾਂ ਨੂੰ ਚਿਪਕ ਜਾਂਦੀ ਹੈ ਜਿਸ ਕਾਰਨ ਪੱਕਦੀ ਨਹੀਂ ਹੈ ਅਤੇ ਇਹ ਟੁੱਟ ਜਾਂਦੀ ਹੈ ਅਤੇ ਹੁਣ ਤੰਦੂਰੀ ਰੋਟੀ ਵੀ ਸੇਮ ਹੱਥਾਂ 'ਤੇ ਪਕਾਉਣੀ ਪੈਂਦੀ ਆ ਅਤੇ ਉਹ ਵੀ ਹੱਥਾਂ ਦੇ ਨਾਲ ਚਿਪਕ ਕੇ ਟੁੱਟ ਜਾਂਦੀ ਹੈ ਜਿਸ ਤੰਦੂਰ ਵਿੱਚੋਂ ਲਾਹੁਣ ਦੀ ਗੱਲ ਕਰੀਏ ਤਾਂ ਹੱਥਾਂ ਨੂੰ ਸੇਕ ਲੱਗਦਾ ਹੈ ਹੱਥਾਂ ਨੂੰ ਸੇਕ ਲੱਗਦਾ ਹੈ ਅਤੇ ਬਾਹਵਾਂ ਵੀ ਸੜਦੀਆਂ ਹਨ ਇਸ ਕਰਕੇ ਇਹ ਪਕਵਾਨ ਬਣਾਉਣੇ ਬਹੁਤ ਮੁਸ਼ਕਿਲ ਲੱਗਦੇ ਹਨ